ਹੈਲੋ ਹਾਂਜੀ ਹਾਂਜੀ ਸਰ ਹਾਂਜੀ ਕੌਣ ਗੱਲ ਕਰ ਰਹੇ ਹੋ ਸਰ ਜੀ ਜੀ ਜੀ ਜੀ

ਨਹੀਂ ਵੇਖੋ ਸਰ ਨਹੀਂ ਸਰ ਇੱਕ ਅਸੀਂ ਜਿਹੜੇ ਕਿ ਜੀ ਵੇਖੋ ਸਰ ਇਸ 'ਤੇ ਨਹੀਂ ਯਤਨ ਵੇਖੋ ਸਰ ਅਸੀਂ ਇਸ ਵੱਲ ਕਾਫੀ ਜਿਹੜਾ ਹੈਗਾ ਧਿਆਨ ਦੇ ਰਹੇ ਹੈਗੇ ਜਿਹੜੀ ਕਿ ਸਾਡੀ ਸਰਕਾਰ ਹੁਣ ਇਸ ਵੱਲ ਕਾਫੀ ਜਿਹੜਾ ਹੈਗਾ ਧਿਆਨ ਵਿੱਚ ਕਿਉਂਕਿ ਇਹ ਤਾਂ ਅਸੀਂ ਹੁਣ ਜਿਹੜੇ ਇੱਕ ਤਾਕਤ ਹ ਹੋਰਨਾਂ ਪੁਲਿਸ ਤੱਕ ਟੀਮ ਜਿਹੜੀ ਬਣਾਈ ਹੋਈ ਹੈਗੀ ਜਿਹੜੀ ਕਿ ਰਾਤ ਨੂੰ ਰੋਡ ਦਾ ਏਰੀਆ ਉਨ੍ਹਾਂ ਨੂੰ ਦਿੱਤਾ ਹੋਇਆ ਹੈਗਾ ਵੀ ਕਿਤੇ ਵੀ ਕੋਈ ਵੀ ਕ੍ਰਾਈਮ ਹੁੰਦਾ ਤੁਸੀਂ ਉਨ੍ਹਾਂ ਨੂੰ ਨੰਬਰ ਡਾਇਲ ਕਰੋ ਅਤੇ ਉਹ ਉੱਥੇ ਹੀ ਤੁਰੰਤ ਪਹੁੰਚਦੀ ਹੈ ਬਾਕੀ ਨਸ਼ੇ 'ਤੇ ਵੀ ਅਸੀਂ ਦਿਨੋਂ ਦਿਨ ਹੁਣ ਕੰਟਰੋਲ ਕਰ ਰਹੇ ਹਾਂ ਛਾਪਾਮਾਰੀ ਜਿਹੜੀ ਸਾਡੇ ਨਵੇਂ ਅਫਸਰ ਹੈਗੇ ਨੇ ਉਨ੍ਹਾਂ ਨੂੰ ਉਹ ਕਰ ਰਹੇ ਨੇ ਗੇ ਦਿਨੋਂ ਦਿਨ ਜਿਹੜਾ ਹੈ ਕਿ ਘਟਾ ਰਹੇ ਨਸ਼ੇ ਦਾ ਅਸੀਂ ਅਤੇ ਅੱਗੇ ਹੋਰ ਵੀ ਇਸ 'ਤੇ ਅਸੀਂ ਕਾਫੀ ਕਰ ਰਹੇ ਹਾਂ

ਓਕੇ ਕੋਈ ਗੱਲ ਨਹੀਂ ਸਰ ਤੁਸੀਂ ਤੁਸੀਂ ਸਰ ਇਹ ਸਾਨੂੰ ਧਿਆਨ ਦੇ ਵਿੱਚ ਲਿਆਂਦਾ ਅਸੀਂ ਤੁਹਾਡੇ ਜਿਹੜਾ ਲੋਕਲ ਥਾਣਾ ਹੈਗਾ ਉਸ ਦੇ ਜੋ ਵੀ ਅਧਿਕਾਰੀ ਹੈਗੇ ਨੇ ਪੁਲਿਸ ਮੁਲਾਜ਼ਮ ਉਨ੍ਹਾਂ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਕੇ ਉਨ੍ਹਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪੂਰਾ ਉਨ੍ਹਾਂ ਨੂੰ ਕੰਟਰੋਲ ਕਰਨ ਲਈ ਕਹਾਂਗੇ ਅਸੀਂ ਉਨ੍ਹਾਂ ਨਾਲ ਜਿਹੜਾ ਕਿ ਵੀ ਕਾਰਵਾਈ ਕਰਨ ਅਤੇ ਅੱਗੇ ਤੋਂ ਵੀ ਅਸੀਂ ਹੋਰ ਵੀ ਕਾਰਵਾਈ ਜਿਹੜੀ ਵਧਾ ਰਹੇ ਹਾਂ ਨਸ਼ੇ ਦੇ ਖਿਲਾਫ ਠੀਕ ਅਤੇ ਜਲਦ ਤੋਂ ਜਲਦੀ ਤੁਹਾਡੀ ਜਿਹੜੀ ਕੰਪਲੇਂਟ ਹੈ ਅਸੀਂ ਹਾਂ ਤੁਹਾਡੀ ਉਮੀਦਾਂ 'ਤੇ ਅਸੀਂ ਖਰੇ ਉਤਰਾਂਗੇ ਬਿਲਕੁਲ ਬਿਲਕੁਲ ਨਹੀਂ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਜਲਦੀ ਤੋਂ ਜਲਦੀ ਅਸੀਂ ਤੁਹਾਡੀ ਇਸ ਗੱਲ ਲਈ ਖਰੇ ਉਤਰਾਂਗੇ ਅਤੇ ਤੁਸੀਂ ਇਸ ਗੱਲ 'ਤੇ ਟੈਨਸ਼ਨ ਨਾ ਲਓ ਓਕੇ ਸਰ ਧੰਨਵਾਦ